ਜਿਵੇਂ ਕਿ ਮਾਰਕਿਟ ਵਿੱਚ ਬਹੁਤ ਜੁੱਤਿਆਂ ਦੀ ਕੰਪਨੀਆਂ ਹਨ ਬਟ ਮੇਰੀ ਸਭ ਤੋਂ ਮਨਪਸੰਦ ਜੁ ਜੁੱਤੀਆਂ ਦੀ ਕੰਪਨੀ ਪਿਉਮਾ ਹੈ ਮੈਂ ਕਾਫ਼ੀ ਸਮੇਂ ਤੋਂ ਸੋਚ ਰਿਹਾ ਸੀਗਾ ਕਿ ਮੈਂ ਇੱਕ ਜੁੱਤਾ ਔਰਡਰ ਕਰਨਾ ਹੈ ਤਾਂ ਹੁਣ ਫ ਪਿਛਲੇ ਮਹੀਨੇ ਸੇਲ ਲੱਗੀ ਸੀ ਤਾਂ ਮੈਂ ਉਹ ਜੁੱਤਾ ਔਰਡਰ ਕਰ ਲਿੱਤਾ ਹੈ ਜਿਹੜੇ ਮੇਰੇ ਪੁਰਾਣੇ ਜੁੱਤੇ ਸੀਗੇ ਉਸ ਨਾਲ਼ ਮੈਂ ਰਨਿੰਗ ਕਰਦਾ ਸੀਗਾ ਜਿਸ ਕਰਕੇ ਮੇਰੇ ਪੈਰਾਂ 'ਚ ਬੜਾ ਦਰਦ ਰਹਿੰਦਾ ਸੀਗਾ ਉਹ ਕੰਫਰਟੇਬਲ ਨਹੀਂ ਸੀਗੇ ਤਾਂ ਜਿੱਦਾਂ ਕਿ ਮੈਂ ਕਾਫ਼ੀ ਲੋਕਾਂ ਤੋਂ ਸੁਣਿਆ ਸੀਗਾ ਕਿ ਉਸ ਕੰਪਨੀ ਦੇ ਜੁੱਤੇ ਕਾਫ਼ੀ ਅੱਛੇ ਹਨ ਤਾਂ ਜਿੱਦਾਂ ਹੀ ਮੈਂ ਮੈਨੂੰ ਸੇਲ ਲੱਗੀ ਤਾਂ ਮੈਂ ਉਹ ਔਰਡਰ ਕੀਤਾ ਜਿੱਦਾਂ ਹੀ ਮੇਰੇ ਘਰ ਆਏ ਮੈਂ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਹਨਾਂ ਦੀ ਇੱਕ ਪੈਕਿੰਗ ਬਹੁਤ ਅੱਛੀ ਸੀਗੀ ਨਾ ਕਿਤੋਂ ਫਟੇ ਹੋਏ ਸੀਗੇ ਡੱਬਾ ਵੀ ਸਮੇਤ ਸਾਰਾ ਠੀਕ ਸੀਗਾ ਜਦੋਂ ਮੈਂ ਉਹ ਖੋਲ੍ਹਿਆ ਜ ਮੈਨੂੰ ਮੈਨੂੰ ਡਰ ਸੀਗਾ ਕਿ ਉਹ ਮੇਰੇ ਫੀਟਿੰਗ ਆਉਂਗੇ ਵੀ ਨਹੀਂ ਆਉਣਗੇ ਤਾਂ ਮੈਂ ਪਾ ਕੇ ਦੇਖਿਆ ਉਹ ਮੇਰੇ ਪੈਰ 'ਚ ਬਿਲਕੁਲ ਫਿੱਟ ਸੀਗੇ ਉਹਨਾਂ ਦਾ ਰੰਗ ਜਿੱਦਾਂ ਹੀ ਫੋਟੋ 'ਚ ਸੀਗਾ ਉੱਦਾਂ ਦਾ ਹੀ ਉਹ ਮੈਨੂੰ ਮਿਲੇ ਹਨ ਅਤੇ ਉਹ ਬੜੇ ਹੀ ਅਰਾਮਦਾਇਕ ਹਨ ਜਿਸਨੂੰ ਪਾ ਕੇ ਮੈਂ ਹੁਣ ਦੋ ਦਿਨ ਤੋਂ ਰਨਿੰਗ ਕਰ ਰਿਹਾ ਸੀਗਾ ਜਿਸ ਨਾਲ਼ ਮੇਰੀ ਪੈਰ ਦਾ ਸਾਰਾ ਦਰਦ ਵੀ ਮਿਟ ਚੁੱਕਿਆ ਹੈ ਅਤੇ ਮੈਂ ਬੜਾ ਕੰਫਰਟੇਬਲ ਫੀਲ ਕਰਦਾ ਹਾਂ ਉਹਨਾਂ ਜੁੱਤਿਆਂ ਨੂੰ ਖਰੀਦ ਕੇ